ਪੰਜਾਬ ਦੇ ਵਿੱਚ ਸਿੱਖ ਧਰਮ ਦੇ ਨਾਲ ਜੁੜੇ ਹੋਏ ਲੋਕ ਸਾਨੂੰ ਜ਼ਿਆਦਾ ਮਿਲ ਜਾਂਦੇ ਹਨ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਆਗਮਨ ਦਸ ਗੁਰੂਆਂ ਦੇ ਆਗਮਨ ਨਾਲ ਹੋਇਆ ਹੈ ਗੁ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਇਸ ਧਰਮ ਦੀ ਸ਼ੁਰੂਆਤ ਹੋਈ ਹੈ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਨਾਅਰਾ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਕਿਰਤ ਕਮਾਈ ਕਰਨ ਦੇ ਲਈ ਕਿਹਾ ਹੈ ਉਸ ਤੋਂ ਬਾਅਦ ਅਸੀਂ ਉਸ ਵਾਹਿਗੁਰੂ ਦਾ ਨਾਮ ਲੈਣਾ ਹੈ ਅਤੇ ਉਸ ਤੋਂ ਬਾਅਦ ਅਸੀਂ ਆਪਣੀ ਜੋ ਕਮਾਈ ਹੈ ਉਸ ਨੂੰ ਵੰਡ ਕੇ ਸਭ ਨੇ ਛਕਣਾ ਹੈ ਮਤਲਬ ਸਭ ਤੋਂ ਪਹਿਲਾਂ ਉਹਨਾਂ ਨੇ ਕਿਰਤ ਨੂੰ ਪ੍ਰਧਾਨ ਬਣਾਇਆ ਹੈ ਕਿ ਅਸੀਂ ਕੰਮ ਨਹੀਂ ਛੱਡਣਾ ਆਪਣੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਦੇ ਨਾਲ ਹੀ ਅੱਗੇ ਵਧਣਾ ਹੈ ਅਸੀਂ ਕਿਸੇ ਦੇ ਸਿਰ ਤੋਂ ਨਹੀਂ ਖਾਣਾ ਹੈਗਾ ਅਸੀਂ ਆਪਣੀ ਹੀ ਕਿਰਤ ਕਮਾਈ ਹੈ ਉਹੀ ਕਰਨੀ ਹੈ ਇਸ ਤਰ੍ਹਾਂ ਦਸਾਂ ਗੁਰੂਆਂ ਨੇ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਹਨ ਜਿਨ੍ਹਾਂ ਦਾ ਅਸੀਂ ਅੱਜ ਪਾਲਣਾ ਕਰਦੇ ਹਾਂ ਸਿੱਖਾਂ ਗੁਰੂਆਂ ਦੀ ਬਾਣੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈ ਜਿਨ੍ਹਾਂ ਨੂੰ ਸਿੱਖ ਪੜ੍ਹਦੇ ਹਨ ਜਿਨ੍ਹਾਂ ਤੋਂ ਉਹ ਸਿੱਖਿਆ ਲੈਂਦੇ ਹਨ ਅਤੇ ਉਨ੍ਹਾਂ ਅਨੁਸਾਰ ਹੀ ਆਪਣਾ ਜੀਵਨ ਢਾਲਦੇ ਹਨ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਸਾਨੂੰ ਜੀਵਨ ਬਾਰੇ ਗੱਲਾਂ ਦੱਸੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ ਸਾਨੂੰ ਸਿਰਫ ਇੱਕ ਗੁਰੂ ਨੂੰ ਧਿਆਉਣਾ ਚਾਹੀਦਾ ਹੈ ਉਸ ਅਕਾਲ ਪੁਰਖ ਨੂੰ ਮੰਨਣਾ ਚਾਹੀਦਾ ਹੈ ਸਾਨੂੰ ਉਸ ਅਕਾਲ ਪੁਰਖ ਦੇ ਰੂਪ ਉਸ ਊਰਜਾ ਬਾਰੇ ਸਾਨੂੰ ਦੱਸਿਆ ਹੈ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਸਿੱਖਿਆਵਾਂ ਦੱਸੀਆਂ ਜਿਵੇਂ ਕਿ ਸਾਨੂੰ ਆਪਣੇ ਜੀਵਨ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਹਨ ਸਾਨੂੰ ਇੱਕ ਦਸਵੇਂ ਗੁਰੂ ਨੇ ਸਾਨੂੰ ਇੱਕ ਪਹਿਰਾਵਾ ਦਿੱਤਾ ਹੈ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜਿਸ ਨਾਲ ਸਾਨੂੰ ਇੱਕ ਵਿਸ਼ੇਸ਼ ਨਾਮ ਦਿੱਤਾ ਗਿਆ ਜਿਨ੍ਹਾਂ ਨਾਲ ਸਾਨੂੰ ਅਸੀ ਸਿੱਖ ਕਮਿਊਨਿਟੀ ਦੇ ਰੂਪ ਦੇ ਵਿੱਚ ਸਾਹਮਣੇ ਆਏ ਅਤੇ ਉਹਨਾਂ ਨੇ ਸਾਨੂੰ ਇੱਕ ਬਾਣਾ ਦਿੱਤਾ ਅਤੇ ਜਿਸ ਨਾਲ ਅਸੀਂ ਆਪਣੀ ਦੁਨੀਆ 'ਤੇ ਅਲੱਗ ਪਹਿਚਾਣ ਬਣਾਈ ਅੱਜ ਦੇ ਸਮੇਂ ਵਿੱਚ ਸਿੱਖ ਸਾਰੀ ਦੁਨੀਆ 'ਤੇ ਮਸ਼ਹੂਰ ਹਨ ਉਹਨਾਂ ਬਾਰੇ ਸਾਰੀ ਦੁਨੀਆ ਦੇ ਵਿਸ਼ਵ ਭਰ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਸਾਰੇ ਗੁਰੂਆਂ ਦੀ ਜੋ ਸਿੱਖਿਆ ਹੈ ਉਹਨਾਂ 'ਤੇ ਅਮਲ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਬਾਹਰੋਂ ਦੇਸ਼ਾਂ ਤੋਂ ਆਉਂਦੇ ਹਨ ਇਸ ਸ ਬਾਰੇ ਜਾਣਦੇ ਹਨ ਅਤੇ ਇਹ ਉਹਨਾਂ ਗੁਰੂਆਂ ਦੀਆਂ ਜੋ ਸਿੱਖਿਆਵਾਂ ਹਨ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੀ ਪਾਲਣਾ ਕਰਦੇ ਹਨ ਮਤਲਬ ਗੁਰੂਆਂ ਨੇ ਸਾਨੂੰ ਇੱਕ ਸਿੰਪਲ ਸਾਫ ਸਾਦਾ ਜੀਵਨ ਬਿਤਾਉਣ ਲਈ ਕਿਹਾ ਹੈ ਉਹਨਾਂ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰੱਖਿਆ ਹੈ ਅਸੀਂ ਕਿਸੇ ਵੀ ਤਰ੍ਹਾਂ ਦੇ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ ਹੈ ਅਸੀਂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਆਪਣਾ ਸੀਸ ਝੁਕਾਉਣਾ ਹੈ ਉਹਨਾਂ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਕਿਸੇ ਵੀ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਣਾ ਹੈ ਇਸ ਤਰ੍ਹਾਂ ਉਹਨਾਂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਹਨ ਜਿਨ੍ਹਾਂ ਨੂੰ ਅਸੀ ਆਪਣੇ ਜੀਵਨ ਵਿੱਚ ਲਾਗੂ ਕਰ ਸਕਦੇ ਹਾਂ